ਹੈਲੋ ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ ਕਿਵੇਂ ਹੋ ਮੇਰਾ ਵੀ ਵਧੀਆ ਹੋਰ ਭੈੈਣ ਜੀ ਕੀ ਕਰਦੇ ਹੋ ਅੱਛਾ ਅੱਛਾ ਭੈਣ ਜੀ ਤੁਹਾਨੂੰ ਪਤਾ ਆ ਅੱਜ ਕੱਲ੍ਹ ਪਠਾਨਕੋਟ ਜ਼ਿਲ੍ਹੇ ਵਿੱਚ ਕਿੰਨਾ ਟ੍ਰੈਫਿਕ ਵੱਧ ਗਿਆ ਹੈ ਅਤੇ ਉਹ ਅਤੇ ਪੁਲਿਸ ਵੀ ਇਹਨੂੰ ਕੋਈ ਕੰਟਰੋਲ ਕਰਨ ਵਾਸਤੇ ਕੱਖ ਨਹੀਂ ਕਰਿਆ ਕਰਦੀ ਹੈ ਅਤੇ ਉਹ ਬਸ ਹੱਥ 'ਤੇ ਹੱਥ ਧਰ ਕੇ ਬੈਠੀ ਹੋਈ ਹੈ ਹਾਂਜੀ ਹਾਂਜੀ ਅਸੀਂ ਚਾਹੁੰਦੇ ਹਾਂ ਕਿ ਪੁਲੀਸ ਇਸ ਬਾਰੇ ਵੱਧ ਤੋਂ ਵੱਧ ਕੁਝ ਕਰੇ ਟ੍ਰੈਫਿਕ ਨੂੰ ਲੈ ਕੇ ਚਲੋ ਠੀਕ ਹੈ ਭੈਣ ਜੀ ਓਕੇ